ਮੈਂ ਆਪਣੇ ਵਿਹਲੇ ਸਮੇਂ ਵਿੱਚ ਸੰਗੀਤ ਸੁਣਦੀ ਹਾਂ ਫਿਲਮਾਂ ਦੇਖਦੀ ਹਾਂ ਨਾਟਕ ਦੇਖਦੀ ਹਾਂ ਅਤੇ ਕਿਤਾਬਾਂ ਪੜ੍ਹਦੀ ਹਾਂ ਅਤੇ ਸਕੈੱਚ ਬਣਾਉਂਦੀ ਹਾਂ ਅਤੇ ਕਈ ਵਾਰ ਮੈਂ ਆਪਣੇ ਵਿਹਲੇ ਸਮੇਂ ਵਿੱਚ ਕੁਕਿੰਗ ਕਰਦੀ ਹਾਂ ਕੁਛ ਅਲੱਗ ਅਲੱਗ ਤਰ੍ਹਾਂ ਦਾ ਬਣਾ ਕੇ ਵੇਖਦੀ ਹਾਂ ਅਤੇ ਹੋਰ ਵੀ ਬਹੁਤ ਸਾਰੇ ਕੰਮ ਕਰਦੀ ਹਾਂ ਜਿਵੇਂ ਕਿ ਕੋਈ ਨਵੀਂ ਕਿਤਾਬ ਪੜ੍ਹਦੀ ਹਾਂ ਨਾਟਕ ਵਗੈਰਾ ਪੜ੍ਹਦੀ ਹਾਂ ਨਾਵਲ ਪੜ੍ਹਦੀ ਹਾਂ